ਮੋਹਾਲੀ ਜ਼ਿਲ੍ਹੇ ਵਿੱਚ ਕੁਝ ਮਹੱਤਵਪੂਰਨ ਸਥਾਨ ਇੱਦਾਂ ਦੇ ਹਨ ਜਿਵੇਂ ਕਿ ਵੀ ਆਰ ਪੰਜਾਬ ਗੁਰਦੁਆਰਾ ਸੋਹਾਣਾ ਸਾਹਿਬ ਅਤੇ ਥ੍ਰੀ ਬੀ ਟੂ ਮਾਰਕੀਟ ਜਿੱਥੇ ਕਿ ਲੋਕ ਵੱਧ ਤੋਂ ਵੱਧ ਆਉਂਦੇ ਹਨ ਗੁਰਦੁਆਰੇ ਵਿੱਚ ਵੀ ਅਤੇ ਥ੍ਰੀ ਬੀ ਟੂ ਦੀ ਮਾਰਕੀਟ ਵਿੱਚ ਵੀ ਅਤੇ ਵੀ ਆਰ ਪੰਜਾਬ ਵਿੱਚ ਵੀ ਘੁੰਮਣ ਆਉਂਦੇ ਹਨ